ਭਾਰਤ ਇੱਕ ਡੈਮੋਕਰੈਟਿਕ ਕੰਟਰੀ ਹੈ ਅਤੇ ਪੰਜਾਬ ਭਾਰਤ ਵਿੱਚ ਹੀ ਪੰਜਾਬ ਸ਼ਾਮਿਲ ਹੈ ਅਤੇ ਹਰ ਹਰ ਇੱਕ ਨਾਗਰਿਕ ਦਾ ਵੋਟ ਪਾਉਣਾ ਹੱਕ ਹੈ ਅਤੇ ਹਰ ਇਕ ਨਾਗਰਿਕ ਵੋਟ ਦੇ ਜ਼ਰੀਏ ਹੀ ਸਿਆਸੀ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਅਤੇ ਹਰ ਇੱਕ ਵੋਟਰ ਦੀ ਆਪਣੀ ਅੰਡਰ ਸਟੈਂਡਿੰਗ ਆਪਣੀ ਸੂਝ ਬੂਝ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਉਮੀਦਵਾਰ ਨੂੰ ਵੋਟ ਪਾਵੇ ਅਤੇ ਹਰ ਨਾਗਰਿਕ ਨੂੰ ਸੋਚ ਵਿਚਾਰ ਕਰਕੇ ਹੀ ਆਪਣਾ ਲੀਡਰ ਆਪਣਾ ਸਿਆਸੀ ਲੀਡਰ ਚੁਣਨਾ ਚਾਹੀਦਾ ਹੈ ਅਤੇ ਉੱਥੇ ਜੇਕਰ ਹਰ ਨਾਗਰਿਕ ਸੋਚ ਸਮਝ ਕੇ ਸਹੀ ਕੈਂਡੀਡੇਟ ਨੂੰ ਆਪਣੀ ਵੋਟ ਪਾਵੇਗਾ ਤਾਂ ਹੀ ਅਸਲ ਡੈਮੋਕਰੇਟਿਕ ਦਾ ਮਾਹੌਲ ਭਾਰਤ ਵਿੱਚ ਬਣਾਇਆ ਜਾ ਸਕਦਾ ਹੈ